ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਹੈ ਜੋ ਕਿ ਬਹੁਤ ਜ਼ਿਆਦਾ ਪੰਜਾਬ 'ਚ ਬੋਲੀ ਜਾਂਦੀ ਹੈ ਇਹ ਭਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਜੋ ਕਿ ਸਿੱਖਾਂ ਦੀ ਗੁਰਮੁਖੀ ਭਾਸ਼ਾ ਵੀ ਮੰਨੀ ਜਾਂਦੀ ਹੈ ਅਤੇ ਇਹਦੇ ਨਾਲ ਬੋਲਣਾ ਬੋਲਣ ਨਾਲ ਅਤੇ ਅਸੀਂ ਆਪਣੇ ਆਪ ਨੂੰ ਸਿਖਾਲਾ ਫੀਲ ਕਰਦੇ ਹਾਂ ਅਤੇ ਹੋਰ ਜਿਵੇਂ ਹੋਰ ਭਾਸ਼ਾ ਵੀ ਪੰਜਾਬ 'ਚ ਹੋਰ ਖਿੱਤਿਆਂ ਦੇ ਲੋਕ ਆਉਣ ਕਰਕੇ ਜਾਂ ਵੱਖ ਵੱਖ ਖੇਤਰਾਂ 'ਚ ਕੰਮ ਕਰਨ ਕਰਕੇ ਉਹਨਾਂ ਦੀਆਂ ਭਾਸ਼ਾ ਵੀ ਵਿੱਚ ਮਿਕਸ ਹੋ ਚੁੱਕੀਆਂ ਹਨ ਤਾਂ ਤਾਂ ਕਰਕੇ ਇੱਥੇ ਪੰਜਾਬ 'ਚ ਪੰਜਾਬੀ ਹਿੰਦੀ ਅਤੇ ਇੰਗਲਿਸ਼ ਨੂੰ ਮਿਕਸ ਕਰਕੇ ਬੋਲਦੇ ਹਨ ਅਤੇ ਮਿਕਸ ਕਰਕੇ ਬੋਲਣ ਦਾ ਇਹ ਮਤਲਬ ਹੈ ਕਿ ਵੀ ਉਹ ਸਾਰੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ ਚਾਹੁੰਦੇ ਹਨ ਜਿਵੇਂ ਕਿ ਆਪਣਾ ਹੋਸਪਿਟਲ ਹੋ ਗਿਆ ਕੋਲਜ ਹੋ ਗਏ ਅਤੇ ਵੱਖ ਵੱਖ ਖੇਤਰਾਂ ਵਿੱਚ ਅਲੱਗ ਅਲੱਗ ਭਾਸ਼ਾ ਦਾ ਯੂਜ਼ ਕੀਤਾ ਜਾਂਦਾ ਹੈ